ਕਿਤਾਬ ਨੂੰ ਪੂਰਾ ਕਰਨ ਲਈ ਮੇਰੇ ਕੋਲ ਕੋਈ ਸਮਾਂ ਨਹੀਂ ਹੈ ਮੇਰਾ ਜਦੋਂ ਸਮਾਂ ਲੱਗਦਾ ਹੈ ਮੈਂ ਉਦੋਂ ਪੜ੍ਹ ਲੈਂਦੀ ਹਾਂ ਮੈਨੂੰ ਬਹੁਤ ਸ਼ੌਂਕ ਹੈ ਵੈਸੇ ਕਿਤਾਬਾਂ ਪੜ੍ਹਨ ਦਾ ਅਤੇ ਮੈਂ ਪੰਜ ਜਾਂ ਦਸ ਮਿੰਟ ਤੱਕ ਹੀ ਪੜ੍ਹ ਸਕਦੀ ਹਾਂ ਜ਼ਿਆਦਾ ਸਿੱਧਾ ਮਤਲਬ ਜੋ ਪੜ੍ਹਨਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਮੇਰੇ ਕੋਲ ਕੁਝ ਖ਼ਾਸ ਗੱਲ ਨਹੀਂ ਹੈ